ਹੈਲੋ ਸਤਿ ਸ਼੍ਰੀ ਅਕਾਲ ਸਰ ਹਾਂਜੀ ਆਪਣੇ ਸਪੋਰਟਸ ਕਲੱਬ ਤੋਂ ਬੋਲ ਰਹੇ ਬਠਿੰਡਾ ਤੋਂ ਜੀ ਅੱਛਾ ਜੀ ਉਹ ਨਾ ਆਪਣੇ ਬੱਚਿਆਂ ਨੂੰ ਇੱਧਰ ਗੇਮਾਂ ਦੇ ਵਿੱਚ ਕਰਾਉਣਾ ਸੀਗਾ ਆਪਣੇ ਹਾਂਜੀ ਅਤੇ ਠੀਕ ਆ ਜੀ ਕਿਉਂਕਿ ਬੱਚੇ ਨੇ ਅੱਜ ਕੱਲ੍ਹ ਮੋਬਾਈਲ ਦੇ ਵਿੱਚ ਜ਼ਿਆਦਾ ਅੱਜ ਕੱਲ੍ਹ ਹੋ ਰਹੇ ਨੇ ਨੁਕਸਾਨ ਹੋ ਰਿਹਾ ਤਾਂ ਕਰਕੇ ਮੈਂ ਸੋਚ ਰਿਹਾ ਸੀ ਵੀ ਹਾਂਜੀ ਹਾਂਜੀ ਹਾਂਜੀ ਅਤੇ ਕਿਹੜੀਆਂ ਕਿਹੜੀਆਂ ਗੇਮਾਂ ਆਪਣੇ

ਠੀਕ ਆ ਠੀਕ ਆ ਸਾਰੀਆਂ ਹੀ ਗੇਮਾਂ ਜੀ ਠੀਕ ਆ ਜੀ ਅਤੇ ਕਿੰਨੀ ਫੀਸ ਆਪਣੀ ਇਹਦੀ ਆਪਣੀ ਸਾਰੀ ਚਾਰ ਹਜ਼ਾਰ ਰੁਪਈਆ ਮਹੀਨੇ ਦੀ ਠੀਕ ਆ ਜੀ ਅਤੇ ਕੀ ਕਲਾਸਾਂ ਮਤਲਬ ਕੀ ਟਾਈਮਿੰਗ ਆ ਕਲਾਸਾਂ ਦੀ ਕਿੰਨੇ ਤੋਂ ਕਿੰਨੇ ਵਜੇ ਤੱਕ ਜੀ ਅੱਛਾ ਅੱਠ ਤੋਂ ਦੋ ਵਜੇ ਤੱਕ ਜੀ ਠੀਕ ਹੈ ਠੀਕ ਹੈ ਜੀ ਚਲੋ ਅੱਜ ਕੱਲ੍ਹ ਫਿਰ ਪੜ੍ਹਾਈ ਦੇ ਵਿੱਚ ਤਾਂ ਬਹੁਤ ਜ਼ਿਆਦਾ ਆ ਰਿਹਾ ਮੈਂ ਸੋਚ ਰਿਹਾ ਸੀ ਵੀ ਗੇਮਾਂ ਦੇ ਵਿੱਚ ਬੱਚਿਆਂ ਨੂੰ ਅੱਗੇ ਲੈ ਕੇ ਜਾਇਆ ਜਾਵੇ ਹਾਂਜੀ ਹਾਂਜੀ ਹਾਂਜੀ ਨਾਲੇ ਸਰੀਰਕ ਫਿਟਨੈਸ ਰਹੇਗੀ ਬੱਚਿਆਂ ਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਟੂਰਨਾਮੈਂਟ ਵੀ ਕਰਾਉਂਦੇ ਤੁਸੀਂ ਅੱਗੇ ਜੀ ਠੀਕ ਹੈ ਜੀ ਅਤੇ ਅੱਛਾ ਡਾਕੂਮੈਂਟ ਵੀ ਚਾਹੀਦੇ ਹੋਣਗੇ ਮਤਲਬ ਕਿ ਟੈਂਨਥ ਪਲੱਸ ਟੂ ਦੇ ਠੀਕ ਆ ਠੀਕ ਹੈ ਜੀ ਅਤੇ ਅੱਛਾ ਜੀ ਠੀਕ ਆ ਠੀਕ ਆ ਚਲੋ ਵਧੀਆ ਤੁਸੀਂ ਕਰਾ ਦਿਓ ਗੇਮਾਂ ਦੀ ਤਿਆਰੀ ਬੱਚਿਆਂਂ ਦੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਤਾਂ ਹੈ ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈ ਜੀ ਠੀਕ ਠੀਕ ਹੈ ਜੀ ਚਲੋ ਠੀਕ ਆ ਜੀ ਆਉਂਦੇ ਫਿਰ ਕਿਸੇ ਦਿਨ ਅਸੀਂ ਅਤੇ ਇਕ ਤਰੀਕ ਤੋਂ ਕਲਾਸਾਂ ਸਟਾਰਟ ਹੋਣਗੀਆਂ ਜੀ ਠੀਕ ਹੈ ਠੀਕ ਹੈ ਜੀ ਚਲੋ ਠੀਕ ਆ ਜੀ ਫਿਰ ਓਕੇ ਜੀ